ਹਾਂਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਘਰ ਬਿਜਲੀ ਚੌਵੀ ਘੰਟੇ ਆਉਂਦੀ ਹੈ ਵੱਖ ਵੱਖ ਮੌਸਮਾਂ ਦੌਰਾਨ ਬਿਜਲੀ ਦੇ ਕੱਟ ਸਾਡੇ ਬਹੁਤ ਹੀ ਘੱਟ ਲੱਗਦੇ ਹਨ ਸਾਡੇ ਘਰ ਦੀ ਜਿਹੜੀ ਬਿਜਲੀ ਹੈ ਉਹ ਚੌਵੀ ਘੰਟੇ ਹੀ ਰਹਿੰਦੀ ਹੈ ਕੀ ਕਹਿਣਾ ਹਨੇਰੀ ਤੂਫਾਨ ਮੀਂਹ ਝੱਖੜ ਕਾਰਨ ਅੱਧਾ ਪੌਣਾ ਘੰਟਾ ਬੰਦ ਹੋ ਜਾਵੇ ਪਰ ਇਹ ਕਦੇ ਵੀ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਅੱਠ ਅੱਠ ਘੰਟਿਆਂ ਦਾ ਜਾਂ ਚਾਰ ਚਾਰ ਘੰਟਿਆਂ ਦਾ ਕੋਈ ਕੱਟ ਲੱਗਿਆਂ ਹੋਵੇ ਸਾਡੇ ਪਿੰਡ ਵਿੱਚ ਦੋ ਸੌ ਵੀਹ ਕੇ ਵੀ ਗਰਿੱਡ ਹੈ ਜਿਸ ਨਾਲ ਸਾਡੇ ਪਿੰਡ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਨਿਰਵਿਘਨ ਮਿਲਦੀ ਹੈ ਮੈਂ ਇੱਕ ਕਿਸਾਨ ਹਾਂ ਸਾਨੂੰ ਖੇਤਾਂ ਵਾਲੀ ਬਿਜਲੀ ਵੀ ਚੰਗੀ ਮਿਲ ਰਹੀ ਹੈ ਅਤੇ ਸਾਡੇ ਪ ਘਰਾਂ ਵਾਲੀ ਬਿਜਲੀ ਵੀ ਬਹੁਤ ਵਧੀਆ ਚੱਲ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਮਹੀਨੇ ਸਾਡੇ ਪਿੰਡ ਵਿੱਚ ਬਹੁਤ ਹਨੇਰੀ ਤੂਫਾਨ ਆਇਆ ਸੀ ਅਤੇ ਉਸ ਕਾਰਨ ਜਿਹੜੀ ਬਿਜਲੀ ਸੀ ਉਹ ਸਿਰਫ਼ ਅੱਧਾ ਘੰਟਾ ਹੀ ਬੰਦ ਰਹੀ ਸੀ ਕਿਉਂਕਿ ਕਈ ਥਾਵਾਂ ਉੱਤੇ ਖੰਭੇ ਅਤੇ ਤਾਰਾਂ ਡਿੱਗ ਚੁੱਕੀਆਂ ਸੀ ਅਤੇ ਜਿਸ ਕਾਰਨ ਬਿਜਲੀ ਬੋਰਡ ਵਾਲਿਆਂ ਵੱਲੋਂ ਬਿਜਲੀ ਕੱਟ ਦਿੱਤੀ ਗਈ ਸੀ ਜਿ ਜਿਸ ਕਾਰਨ ਕੋਈ ਨੁਕਸ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਅੱਧੇ ਘੰਟੇ ਬਾਅਦ ਹੀ ਬਿਜਲੀ ਆ ਗਈ ਸੀ ਅਤੇ ਸਾਡੀ ਬਿਜਲੀ ਦੀ ਸਪਲਾਈ ਨਿਰਵਿਘਨ ਚਲਦੀ ਹੈ ਅਤੇ ਸਾਡੇ ਪਿੰਡ ਦੇ ਬਿਜਲੀ ਮੁਲਾਜ਼ਮ ਬਹੁਤ ਹੀ ਵਧੀਆ ਹਨ ਕਿਸੇ ਸਮੇਂ ਵੀ ਕੋਈ ਵੀ ਫਾਲਟ ਪੈ ਜਾਂਦਾ ਹੈ ਤਾਂ ਉਹ ਉਸ ਸਮੇਂ ਹੀ ਕੱਢਣ ਦੇ ਲਈ ਆ ਜਾਂਦੇ ਹਨ ਬਹੁਤ ਹੀ ਚੰਗੇ ਇਨਸਾਨ ਹਨ ਅਸੀਂ ਇੱਕ ਫੋਨ ਕਰਦੇ ਹਾਂ ਉਹ ਹਾਜ਼ਰ ਹੋ ਜਾਂਦੇ ਹਨ ਸਾਡੇ ਪਿੰਡ ਵਿੱਚ ਬਿਜਲੀ ਦੀ ਸਥਿਤੀ ਬਹੁਤ ਚੰਗੀ ਹੈ ਕੱਟ ਵਗੈਰਾ ਬਹੁਤ ਘੱਟ ਲੱਗਦੇ ਹਨ ਅਤੇ ਅਸੀਂ ਖੇਤੀਬਾੜੀ ਦਾ ਕੰਮ ਵੀ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਅਤੇ ਸਾਨੂੰ ਜਿਹੜੀ ਇਹ ਪਾਣੀ ਦੀ ਸਪਲਾਈ ਆ ਬਿਜਲੀ ਦੀ ਸਪਲਾਈ ਆ ਉਹ ਬਹੁਤ ਵਧੀਆ ਢੰਗ ਨਾਲ ਮਿਲ ਰਹੀ ਹੈ ਅਸੀਂ ਬਹੁਤ ਖੁਸ਼ ਹਾਂ